ਪਾਣੀ ਨੂੰ ਫਿਲਟਰ ਕਰਨ ਲਈ ਅਤੇ ਸ਼ੁੱਧ ਕਰਨ ਲਈ ਅਸੀਂ ਕਈ ਅਭਿਆਸ ਵਰਤਦੇ ਹਾਂ ਇਹਨਾਂ ਵਿੱਚੋਂ ਕਈ ਘਰੇਲੂ ਇਲਾਜ ਵੀ ਹਨ ਜਿਹੜੇ ਆਪਾਂ ਘਰਾਂ ਦੇ ਵਿੱਚ ਵਰਤਦੇ ਹਾਂ ਪਾਣੀ ਨੂੰ ਸ਼ੁੱਧ ਕਰਨ ਲਈ ਪਾਣੀ ਨੂੰ ਫਿਲਟਰ ਕਰਨ ਲਈ ਘਰਾਂ ਵਿੱਚ ਬਹੁਤ ਘਰੇਲੂ ਤਰੀਕੇ ਵਰਤੇ ਜਾਂਦੇ ਹਨ ਜਿਵੇਂ ਕਿ ਪਾਣੀ ਨੂੰ ਸ਼ੁੱਧ ਕਰਨ ਲਈ ਘੜੇ ਵਿੱਚ ਰੱਖਿਆ ਜਾਂਦਾ ਹੈ ਘੜੇ ਵਿੱਚ ਪਾਣੀ ਰੱਖਣ ਨਾਲ਼ ਪਾਣੀ ਸ਼ੁੱਧ ਹੋ ਜਾਂਦਾ ਹੈ ਨਾਲ਼ ਹੀ ਪਾਣੀ ਘੜੇ ਵਿੱਚ ਠੰਡਾ ਰਹਿੰਦਾ ਹੈ ਕਿਉਂਕਿ ਘੜਾ ਮਿੱਟੀ ਦਾ ਬਇਆ ਬਣਿਆ ਹੋਣ ਕਰਕੇ ਘੜੇ ਵਿੱਚ ਪਾਣੀ ਸ਼ੁੱਧ ਰਹਿੰਦਾ ਹੈ ਇਸ ਤੋਂ ਇਲਾਵਾ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਵੀ ਸ਼ੁੱਧ ਕੀਤਾ ਜਾਂਦਾ ਹੈ ਪਾਣੀ ਉਬਾਲ ਕੇ ਰੱਖਣ ਨਾਲ਼ ਪਾਣੀ ਦੀ ਸ਼ੁੱਧਤਾ ਹੋ ਜਾਂਦੀ ਹੈ ਪਾਣੀ ਵਿੱਚ ਜੇਕਰ ਆਪਾਂ ਫਿਟਕਰੀ ਪਾ ਕੇ ਰੱਖ ਦਈਏ ਤਾਂ ਪਾਣੀ ਸ਼ੁੱਧ ਹੋ ਜਾਂਦਾ ਹੈ ਪਾਣੀ ਨੂੰ ਸਾਫ਼ ਰੱਖਣ ਲਈ ਫਿਲਟਰਾਂ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈ ਆਮ ਤੌਰ 'ਤੇ ਘਰਾਂ ਵਿੱਚ ਪਾਣੀ ਨੂੰ ਸ਼ੁੱਧ ਕਰਨ ਲਈ ਫਿਲਟਰ ਲੱਗੇ ਹੋਏ ਹਨ ਆਮ ਤੌਰ 'ਤੇ ਬਾਜ਼ਾਰ ਵਿੱਚੋਂ ਗੋਲੀਆਂ ਵੀ ਮਿਲ ਜਾਂਦੀਆਂ ਹਨ ਜੋ ਪਾਣੀ ਵਿੱਚ ਪਾਉਣ ਨਾਲ਼ ਪਾਣੀ ਸ਼ੁੱਧ ਹੋ ਜਾਂਦਾ ਹੈ ਪਾਣੀ ਨੂੰ ਸ਼ੁੱਧ ਕਰਨ ਲਈ ਆਪਾਂ ਕਈ ਘਰੇਲੂ ਤਰੀਕੇ ਅਪਣਾ ਸਕਦੇ ਹਨ ਪਾਣੀ ਸਾਡੇ ਲਈ ਬਹੁਤ ਜ਼ਰੂਰੀ ਹੈ ਪਾਣੀ ਨੂੰ ਪੀਣ ਯੋਗ ਬਣਾਉਣ ਲਈ ਕਈ ਘਰੇਲੂ ਤਰੀਕਿਆਂ ਨੂੰ ਵਰਤਿਆ ਜਾ ਸਕਦਾ ਹੈ